ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਨਾਮ ਕੀ ਅੱਛਾ ਤੁਸੀਂ ਹਜੇ ਕਿੰਨੇ ਤਰੀਕ ਨੂੰ ਆਏ ਸੀ ਛੇ ਤਰੀਕ ਨੂੰ ਠੀਕ ਆ ਅਤੇ ਹਾਂਜੀ ਅੱਛਾ ਸਿਰ ਪੀੜ ਹੁੰਦੀ ਆ ਠੀਕ ਆ ਤੁਸੀਂ ਨਾ ਦਸ ਦਿਨ ਬਾਅਦ ਆ ਜਿਓ ਤੁਹਾਡੀ ਦਵਾਈ ਬਦਲ ਦਾਂਗੇ ਚਲੋ ਠੀਕ ਆ ਤੁਸੀਂ ਇੱਦਾਂ ਕਰਿਓ ਜੇ ਹੁਣ ਫਰੀ ਜੇ ਤਾਂ ਆਜੋ ਨਹੀਂ ਤਾਂ ਫਿਰ ਕੱਲ੍ਹ ਆ ਜਿਓ ਹਾਂਜੀ ਠੀਕ ਆ ਹਾਂਜੀ ਠੀਕ ਕਿੰਨੇ ਦਿਨ ਲਈ ਲਈ ਸੀ ਠੀਕ ਆ ਅਤੇ ਹੁਣ ਫੀਵਰ ਠੀਕ ਆ ਹੁਣ

ਜੁਕਾਮ ਹੈਗਾ

ਠੰਡ ਲੱਗਦੀ ਠੀਕ ਆ ਹਾਂਜੀ ਤੁਸੀਂ ਇੱਦਾਂ ਕਰੋ ਫਿਰ ਹੁਣੀ ਆ ਜੋ ਤੁਹਾਡੀ ਦਵਾਈ ਚੇਂਜ ਕਰ ਦਾਂਗੀ ਨਾਲੇ ਚੈੱਕ ਕਰਾ ਜੋ ਆ ਕੇ ਹਾਂਜੀ ਠੀਕ ਆ ਹਾਂਜੀ ਮੈਂ ਕਲੀਨਿਕ 'ਤੇ ਹੀ ਹਾਂ ਮੈਂ ਅੱਠ ਵਜੇ ਤੱਕ ਕਲੀਨਿਕ 'ਤੇ ਹੀ ਹਾਂ ਹਾਂਜੀ ਅਤੇ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਆ ਜਿਓ ਹਾਂਜੀ ਠੀਕ ਹੈ ਜੀ ਕਰ ਦਾਂਗੇ ਹਾਂਜੀ ਹਾਂਜੀ ਦੇ ਦਾਂਗੇ ਦਵਾਈ ਤੁਹਾਨੂੰ ਸਿਹਤ ਚੱਲਦੀ ਰਹੂਗੀ ਟੈਂਸ਼ਨ ਨਾ ਲਉ ਹਾਂਜੀ ਚਲੋ ਠੀਕ ਆ ਜੀ